ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਪਈਆਂ ਹਨ ਜ਼ਿਆਦਾਤਰ ਮੈਂ ਪੰਜਾਬੀ ਕਿਤਾਬਾਂ ਹੀ ਪੜ੍ਹਦੀ ਹਾਂ ਅਤੇ ਉਸ 'ਚ ਅਜਿਹੀਆਂ ਘਟਨਾਵਾਂ ਵੀ ਹਨ ਜੋ ਐਦਾਂ ਹੀ ਲੱਗਦਾ ਹੈ ਕਿ ਆਪਣੇ ਨਾਲ਼ ਹੀ ਬੀਤੀ ਹੋਵੇ ਇਸ ਕਰਕੇ ਉਹ ਬੁੱਕਸ ਕਿਤਾਬਾਂ ਮੈਨੂੰ ਬਹੁਤ ਹੀ ਦਿਲਚਸਪ ਲੱਗਦੀਆਂ ਹਨ